ਸਾਡੇ ਖੇਤਰ ਵਿੱਚ ਸੱਭਿਆਚਾਰ ਅਤੇ ਧਾਰਮਿਕ ਪਰੰਪਰਾਵਾਂ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਹਰ ਇੱਕ ਧਰਮ ਦੀਆਂ ਆਪਣੀਆਂ ਪਰੰਪਰਾਵਾਂ ਹਨ ਹਿੰਦੂ ਧਰਮ ਵਿੱਚ ਛੋਟੇ ਬੱਚੇ ਦੇ ਮੁੰਡਨ ਕੀਤੇ ਜਾਂਦੇ ਹਨ ਮਰਗ ਉੱਤੇ ਕਿਰਿਆ ਕਰਵਾਈ ਜਾਂਦੀ ਹੈ ਅਤੇ ਪੰਡਤਾਂ ਨੂੰ ਭੋਜਨ ਛਕਾਇਆ ਜਾਂਦਾ ਹੈ ਇਹਨਾਂ ਵਿੱਚੋਂ ਤੀਰਥ ਯਾਤਰਾ ਨੂੰ ਪਹਿਲ ਦਿੱਤੀ ਜਾਂਦੀ ਹੈ ਮੁਸਲਮਾਨ ਮਸੀਤ ਵਿੱਚ ਜਾ ਕੇ ਚਾਦਰ ਚੜਾਉਂਦੇ ਹਨ ਅਤੇ ਕਵਾਲੀਆਂ ਗਾਈਆਂ ਜਾਂਦੀਆਂ ਹਨ ਇਹਨਾਂ ਵਿੱਚੋਂ ਰੋਜ਼ੇ ਰੱਖੇ ਜਾਂਦੇ ਹਨ ਜੇਕਰ ਕੋਈ ਫੌਤ ਹੋ ਜਾਂਦੀ ਹੈ ਤਾਂ ਉਸਨੂੰ ਦਫ਼ਨਾਇਆ ਜਾਂਦਾ ਹੈ ਸਿੱਖ ਧਰਮ ਵਿੱਚ ਨਵ ਜੰਮੇ ਬੱਚੇ ਨੂੰ ਅੰਮ੍ਰਿਤ ਛਕਾਇਆ ਜਾਂਦਾ ਹੈ ਵਿਆਹ ਤੋਂ ਪਹਿਲੀ ਪਹਿਲਾਂ ਪਾਠ ਕਰਵਾਇਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਤੇਲ ਚੜਾਇਆ ਜਾਂਦਾ ਹੈ ਅਤੇ ਨਾਲ ਹੀ ਸੁਹਾਗ ਗੀਤ ਗਾਏ ਜਾਂਦੇ ਹਨ ਜੇਕਰ ਕੋਈ ਮਰ ਜਾਏ ਤਾਂ ਮੜੀਆਂ ਵਿਚ ਸੰਸਕਾਰ ਕਰਕੇ ਚੌਥਾ ਕੀਤਾ ਜਾਂਦਾ ਹੈ ਅਤੇ ਪਾਠ ਦਾ ਭੋਗ ਪਾਇਆ ਜਾਂਦਾ ਹੈ ਸਾਡੇ ਗੁਰਦੁਆਰਾ ਸਾਹਿਬ ਕੀਰਤਨ ਕੀਤਾ ਜਾਂਦਾ ਹੈ ਗੁਰਧਾਮਾਂ ਦੇ ਦਰਸ਼ਨ ਵੀ ਕਰਨ ਲਈ ਸੰਗਤਾਂ ਜਾਂਦੀਆਂ ਹਨ